ਹਾਂਜੀ ਮੇਰੇ ਕੋਲ ਮੋਬਾਈਲ ਹੈਗਾ ਜੀ ਕਿਹੜਾ ਖਰੀਦਣਾ ਜੀ ਤੁਸੀਂ ਹਾਂਜੀ ਵੀਵੋ ਵੀਹ ਟਵੈਂਟੀ ਨਾਈਨ ਜੀ ਹਾਂਜੀ ਨਵਾਂ ਮਾਡਲ ਆਇਆ ਵਾ ਅਤੇ ਇਹ ਮਾਡਲ ਜਿਹੜਾ ਹੈਗਾ ਜੀ ਇਹ ਬੱਤੀ ਹਜ਼ਾਰ ਰੁਪਏ ਦਾ ਹੈਗਾ ਅਪਰੋਕਸੀਮੇਟਲੀ ਤੇਤੀ ਕੁ ਹਜ਼ਾਰ ਦਾ ਹੈਗਾ ਸੈੱਟ ਅਤੇ ਕਵਡ ਫੇਸ ਹੈਗਾ ਵਾ ਅੱਠ ਜੀ ਬੀ ਇਹਦੀ ਰੈਮ ਹੈਗੀ ਹੈ ਇਹ ਇੱਕ ਸੌ ਅਠਾਈ ਜੀ ਬੀ ਇਹਦੀ ਰੋਮ ਹੈ ਅਤੇ ਕਬਡ ਫੇਸ ਇਹਦਾ ਜਿਹੜਾ ਕੈਮਰਾ ਹੈਗਾ ਹਾਈ ਡੈਂਸਟੀ ਕੈਮਰਾ ਹੈਗਾ ਵਾ ਅੱਠ ਮੈਗਾਪਿਕਸਲ ਅਤੇ ਓਪਰੇਟਿੰਗ ਸਿਸਟਮ ਵੀ ਇਹਦਾ ਬਹੁਤ ਵਧੀਆ ਐਡਰਾਇਡ ਸਿਸਟਮ ਦਾ ਹੈਗਾ ਜੀ ਹਾਂ ਅਤੇ ਹੋਰ ਜਿਹੜੀ ਇਹਦੀ ਐਂਡਰਾਈਡ ਸਿਸਟਮ ਇਹਦਾ ਪ੍ਰੋਸੈਸਰ ਹੈਗਾ ਜੀ